ਪਟਿਆਲਾ ਇੱਕ ਅਜਿਹੇ ਰਾਜ ਵਿੱਚ ਸਥਿਤ ਹੈ ਜਿੱਥੇ ਕਿ ਜਲਵਾਯੂ ਅਕਸਰ ਹੀ ਬਦਲਦਾ ਰਹਿੰਦਾ ਹੈ ਕਦੇ ਵੀ ਜਲਵਾਯੂ ਇੱਥੋਂ ਦਾ ਇੱਕ ਸਮਾਨ ਨਹੀਂ ਰਹਿੰਦਾ ਇਸ ਕਰਕੇ ਲੋਕ ਜਲਵਾਯੂ ਦੇ ਉੱਤੇ ਘੱਟ ਹੀ ਨਿਰਭਰ ਕਰਦੇ ਹਨ ਕਿਉਂਕਿ ਇੱਥੋਂ ਦਾ ਮੌਸਮ ਕਦੇ ਠੰਡਾ ਹੁੰਦਾ ਅਤੇ ਕਦੇ ਗਰਮ ਕਦੇ ਸੀਤ ਹਵਾਵਾਂ ਹੁੰਦੀਆਂ ਨੇ ਕਦੇ ਸੁੱਕੀਆਂ ਹਵਾਵਾਂ ਕਦੇ ਮੌਸਮ ਖਰਾਬ ਹੋਣ ਨਾਲ ਬਾਰਿਸ਼ ਵੀ ਹੋ ਜਾਂਦੀ ਹੈ ਅਤੇ ਕਦੇ ਧੁੰਦ ਵੀ ਪੈ ਜਾਂਦੀ ਹੈ ਸੋ ਕਦੇ ਵੀ ਮਨੁੱਖ ਇੱਥੇ ਰਹਿਣ ਵਾਲਾ ਪਟਿਆਲੇ ਜ਼ਿਲ੍ਹੇ ਦਾ ਮੌਸਮ ਦੇ ਉੱਤੇ ਨਿਰਭਰ ਨਹੀਂ ਕਰਦਾ ਮੌਸਮ ਦੇ ਬਦਲਣ ਦੇ ਨਾਲ ਮਨੁੱਖ ਦੀਆਂ ਲੋੜਾਂ ਮਨੁੱਖ ਦੇ ਸ਼ੌਕ ਮਨੁੱਖ ਦਾ ਪਹਿਰਾਵਾ ਖਾਣ ਪੀਣ ਵੀ ਬਦਲ ਜਾਂਦਾ ਹੈ ਜਿਵੇਂ ਕਿ ਸਿਆਲਾਂ ਦੇ ਵਿੱਚ ਸਰਦੀਆਂ ਦੇ ਵਿੱਚ ਇੱਥੋਂ ਦਾ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਵੀ ਹੋ ਜਾਂਦਾ ਹੈ ਅਤੇ ਸੁੱਕੀਆਂ ਹਵਾਵਾਂ ਚੱਲਦੀਆਂ ਨੇ ਠੰਡੀਆਂ ਹੁੰਦੀਆਂ ਨੇ ਹਵਾਵਾਂ ਧੁੰਦ ਵੀ ਬਹੁਤ ਜ਼ਿਆਦਾ ਪੈ ਜਾਂਦੀ ਹੈ ਜਿਹਨੂੰ ਕਿ ਆਪਾਂ ਕੋਹਰਾ ਵੀ ਕਹਿ ਸਕਦੇ ਹਾਂ ਅਤੇ ਇਸ ਧੁੰਦ ਦੇ ਨਾਲ ਜਿਹੜੀਆਂ ਸਾਡੀਆਂ ਸਬਜ਼ੀਆਂ ਹੁੰਦੀਆਂ ਨੇ ਉਹ ਵੀ ਕਈ ਵਾਰੀ ਖਰਾਬ ਹੋ ਜਾਂਦੀਆਂ ਹਨ ਸਬਜ਼ੀਆਂ ਤੇ ਫਲ ਇਹ ਵੀ ਮੌਸਮ 'ਤੇ ਹੀ ਨਿਰਭਰ ਕਰਦੇ ਨੇ ਜਿਵੇਂ ਜਿਵੇਂ ਮੌਸਮ ਬਦਲਦਾ ਜਾਂਦਾ ਹੈ ਤਾਂ ਫਲ ਅਤੇ ਸਬਜ਼ੀਆਂ ਵੀ ਬਦਲਦੀਆਂ ਨੇ ਲੋਕਾਂ ਦੇ ਰੋਜ਼ਾਨਾ ਜੀਵਨ ਦੇ ਵਿੱਚ ਵੀ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਜਦੋਂ ਸਰਦੀ ਜ਼ਿਆਦਾ ਹੁੰਦੀ ਹੈ ਤਾਂ ਲੋਕ ਮੋਟੇ ਕੱਪੜੇ ਪਾਉਂਦੇ ਨੇ ਜਦੋਂ ਗਰਮੀ ਜ਼ਿਆਦਾ ਹੁੰਦੀ ਤਾਂ ਲੋਕ ਪਤਲੇ ਕੱਪੜੇ ਪਾਉਂਦੇ ਨੇ ਸੋ ਜਿਵੇਂ ਜਿਵੇਂ ਮੌਸਮ ਬਦਲਦਾ ਜਾਂਦਾ ਹੈ ਪਟਿਆਲੇ ਜ਼ਿਲ੍ਹੇ ਦੇ ਰਹਿਣ ਵਾਲੇ ਲੋਕਾਂ ਦੇ ਸ਼ੌਕ ਵੀ ਬਦਲ ਜਾਂਦੇ ਨੇ ਪਹਿਰਾਵੇ ਵੀ ਬਦਲ ਜਾਂਦੇ ਨੇ ਅਤੇ ਖਾਣ ਪੀਣ ਦਾ ਵੀ ਉਹਨਾਂ ਦਾ ਬਦਲਾਅ ਆ ਹੀ ਜਾਂਦਾ ਹੈ